ਤੁਸੀਂ ਕਿਉਂ ਸੋਚਦੇ ਹੋ ਕਿ ਜਦੋਂ ਮਸ਼ਹੂਰ ਹਸਤੀਆਂ ਦਾ ਸਬੰਧ ਹੈ ਤਾਂ ਗੋਪਨੀਤ ਦੀ ਅਜਿਹੀ ਘਾਟ ਅਜਿਹੀ ਘਾਟ ਹੈ ਇਸ ਕਰਕੇ ਹੈ ਵੀ ਜਿਵੇਂ ਕੋਈ ਬੜੀ ਫਾਰਮ ਹੋਵੇ ਜਾਂ ਕਿਸੇ ਦਾ ਨਾਮ ਆ ਵੱਡਾ ਉਹ ਆਪਣੇ ਨਾਂ ਨਾਂ ਦੇ ਨਾਲ ਕੋਈ ਵੀ ਭਾਵੇਂ ਉਹਨੂੰ ਇੱਕ ਰੁਪਏ ਨੂੰ ਵੀ ਲੱਖਾਂ 'ਚ ਤਬਦੀਲ ਕਰ ਸਕਦਾ ਪਰ ਜਿਹੜਾ ਆਪ ਆਮ ਬੰਦਾ ਸਟਰਗਲ ਕਰਦਾ ਉਹ ਮਤਲਬ ਗੋਪਨੀਤਾ ਦੀ ਘਾਟ ਲਾ ਲਓ ਕਹਿਣ ਭਾਵ ਇੱਕ ਤਾਂ ਸਟਾਰਟਿੰਗ ਕਰ ਰਿਹਾ ਹੁੰਦਾ ਪੈਸਾ ਪੈਸੇ ਦੀ ਘਾਟ ਹੋ ਗਈ ਕਿੰਨੀਆਂ ਹੁੰਦੀ ਉਹ ਆਪਣੀ ਮਸ਼ਹੂਰੀ ਜਾਂ ਪਬ੍ਲਿਸਿਟੀ ਨਹੀਂ ਕਰ ਸਕਦਾ ਹੁਣ ਜੇ ਆਪਾਂ ਕਿਸੇ ਮਸ਼ਹੂਰ ਬੰਦੇ ਕੋਲ ਜਾਈਏ ਜੇ ਉਹਦਾ ਹੱਥ ਸਿਰ 'ਤੇ ਹੋਵੇ ਉਹਦਾ ਸਿਰ 'ਤੇ ਹੋਵੇ ਫਿਰ ਤਾਂ ਉਹ ਆਪਾਂ ਨੂੰ ਸਟਰੋਂਗ ਵਿੱਚ ਲੈ ਕੇ ਆ ਸਕਦਾ ਜਿਵੇਂ ਫਸਟ ਨੰਬਰ 'ਤੇ ਲਾ ਲਓ ਇੱਕ ਤਾ ਆਪਣੀ ਐਡ ਕਰੂਗਾ ਦੂਜੇ ਨੰਬਰ 'ਤੇ ਪਿੱਠ 'ਤੇ ਥਾਪੀ ਵੀ ਭਾਈ ਉਹਦੇ ਹੱਥ ਦੀ ਉਹ ਕਹਿੰਦਾ ਕੁਝ ਵੀ ਹੋ ਸਕਦਾ ਮਤਲਵ ਕਹਿਣ ਦੀ ਘਾਟ ਕਹਿਣ ਦਾ ਭਾਵ ਆ ਵੀ ਮਸ਼ਹੂਰ ਬੰਦਿਆਂ ਦਾ ਬੰਦਿਆਂ ਦੀ ਗੱਲ ਵੀ ਵਿਕਦੀ ਆ ਅਤੇ ਆਮ ਬੰਦੇ ਦੀ ਮਿਹਨਤ ਕਰਨ ਦੇ ਬਾਵਜੂਦ ਵੀ ਉਹਨੂੰ ਉਹੀ ਤਕਰੀਬਨ ਉਹੀ ਤਕਰੀਬਨ ਉਹ ਤਾਂ ਸਾਰਾ ਕੁਛ ਮਤਲਬ ਕਹਿਣ ਦਾ ਭਾਵ ਆ ਵੀ ਆਮ ਬੰਦੇ ਦਾ ਜਿੰਨਾ ਮਰਜ਼ੀ ਕੰਮ ਕਰ ਲਵੇ ਭਾਵੇਂ ਬੜ ਬੜੇ ਬੜੇ ਬੰਦੇ ਆ ਜਿਹੜੇ ਉਹ ਆਮ ਬੰਦਿਆਂ ਤੋਂ ਹੀ ਕੰਮ ਕਰਾਉਂਦੇ ਹਾਂ ਅਤੇ ਨਾਮ ਉਹਨਾਂ ਦਾ ਹੁੰਦਾ ਮਤਲਵ ਬੈਕ 'ਤੇ ਕੋਈ ਆਮ ਬੰਦਾ ਹੁੰਦਾ ਜਿਹਦਾ ਨਾਂ ਨਹੀਂ ਹੁੰਦਾ ਅਤੇ ਉਹਨਾਂ ਦਾ ਨਾਂ ਬਣਿਆ ਹੁੰਦਾ ਇਸ ਕਰਕੇ ਮੂਰੀ ਰਹਿੰਦੇ ਹਨ